ਹਾਂਜੀ ਸਾਡੇ ਖੇਤਰ ਵਿੱਚ ਲੋਕਾਂ ਕੋਲ ਬਹੁਤ ਸਾਰੇ ਬ੍ਰਾਂਡ ਦੇ ਫੋਨ ਹਨ ਜਿਵੇਂ ਕਿ ਆਈਫੋਨ ਐਪਲ ਓਪੋ ਵੀਵੋ ਸੈਮਸੰਗ ਨੋਕੀਆ ਮੇਰੇ ਕੋਲ ਇੱਕ ਓਪੋ ਦਾ ਫੋਨ ਹੈ ਹੈ ਅਤੇ ਮੈਂ ਇਸ ਦੇ ਕੋਲੋਂ ਬਹੁਤ ਵਧੀਆ ਸੰਤੁਸ਼ਟ ਹਾਂ ਫੋਨ ਵਿੱਚ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਗੂਗਲ ਇੰਸਟਾਗ੍ਰਾਮ ਯੂਟਿਊਬ ਵਟਸਐਪ ਜਿਸ ਦੇ ਨਾਲ ਅਸੀਂ ਗੂਗਲ ਦੇ ਵਿੱਚੋਂ ਕੁਛ ਵੀ ਸਰਚ ਕਰ ਸਕਦੇ ਹਾਂ ਜੋ ਅਸੀਂ ਲੱਭਣਾ ਚਾਹੁੰਦੇ ਹਾਂ ਸਾਨੂੰ ਕੁਛ ਨਹੀਂ ਆ ਰਿਹਾ ਅਸੀਂ ਉਸ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹਾਂ ਉਹ ਸਾਨੂੰ ਸਭ ਕੁਛ ਗੂਗਲ ਤੋਂ ਮਿਲ ਜਾਂਦਾ ਹੈ ਇੰਸਟਾਗ੍ਰਾਮ ਵੀ ਬਹੁਤ ਵਧੀਆ ਐਪ ਹੈ ਅਤੇ ਵਟਸਐਪ 'ਤੇ ਅਸੀਂ ਚੈਟ ਕਰ ਸਕਦੇ ਹਾਂ ਇੱਕ ਦੂਸਰੇ ਦੇ ਨਾਲ ਅਸੀਂ ਮੈਸੇਜ ਸੈਂਡ ਕਰ ਸਕਦੇ ਹਾਂ ਇਸ ਦੇ ਨਾਲ ਇੱਕ ਦੂਸਰੇ ਨੂੰ ਅਸੀਂ ਦੂਰ ਦੁਰਾਡੇ ਬੈਠੇ ਵੀਡੀਓ ਕਾਲ ਵੀ ਕਰ ਸਕਦੇ ਹਾਂ ਅਤੇ ਇਸ ਦਾ ਸਾਨੂੰ ਬਹੁਤ ਫ਼ਾਇਦਾ ਵੀ ਹੁੰਦਾ ਹੈ ਇਸ ਨਾਲ ਸਾਡਾ ਸਮਾਂ ਵੀ ਬਚਦਾ ਹੈ ਅਤੇ ਸਾਨੂੰ ਨਵੀਆਂ ਨਵੀਆਂ ਐਪਸ 'ਤੇ ਕੰਮ ਕਰਨ ਦਾ ਮੌਕਾ ਵੀ ਮਿਲਦਾ ਹੈ ਯੂਟੀਊਬ 'ਤੇ ਵੀ ਸਾਨੂੰ ਬਹੁਤ ਕੁਛ ਦੇਖਣ ਨੂੰ ਮਿਲਦਾ ਹੈ ਕਿ ਅੱਜ ਕੱਲ੍ਹ ਦੇਸ਼ ਦੇ ਵਿੱਚ ਕੀ ਕੁਛ ਚੱਲ ਰਿਹਾ ਹੈ ਯੂਟੀਊਬ 'ਤੇ ਨਵੀਆਂ ਨਵੀਆਂ ਖ਼ਬਰਾਂ ਆਉਂਦੀਆਂ ਹਨ ਨਵੀਆਂ ਤਾਜ਼ੀਆਂ ਖ਼ਬਰਾਂ ਹੁੰਦੀਆਂ ਹਨ ਜਿਸ ਬਾਰੇ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਆਸ ਪਾਸ ਕੀ ਚੱਲ ਰਿਹਾ ਹੈ ਕਿੱਥੇ ਖੁਸ਼ੀ ਦਾ ਮਾਹੌਲ ਹੈ ਕਿੱਥੇ ਗਮੀ ਦਾ ਮਾਹੌਲ ਹੈ ਸਾਨੂੰ ਇਹਨਾਂ ਸਭ ਬਾਰੇ ਬਹੁਤ ਕੁਛ ਪਤਾ ਚੱਲਦਾ ਹੈ